ਮੈਂ ਹਾਲ ਹੀ ਵਿੱਚ ਇੱਕ ਨਵੇਂ ਅਪਾਰਮੈਂਟ ਵਿੱਚ ਚਲੀ ਗਈ ਸੀਗੀ ਉਸ ਪਤੇ 'ਤੇ ਮੈਨੂੰ ਸਿਲੰਡਰ ਵਗੈਰਾ ਨਹੀਂ ਸੀ ਆ ਰਿਹਾ ਇਸ ਚੱਕਰ ਦੇ ਵਿੱਚ ਫਿਰ ਮੈਂ ਅੱਜ ਜਾ ਕੇ ਉਹਨਾਂ ਨੂੰ ਗੈਸ ਏਜੰਸੀ ਵਿੱਚ ਫੋਨ ਕੀਤਾ ਵੀ ਮੈਨੂੰ ਮੇਰੇ ਸਹੀ ਐਡਰੈਸ 'ਤੇ ਨਵੇਂ ਅਪਾਰਮੈਂਟ ਵਿੱਚ ਸਿਲਿੰਡਰ ਚਾਹੀਦਾ ਇਸ ਚੱਕਰ 'ਚ ਵੀ ਉਹਨਾਂ ਨੇ ਮੇਰੇ ਕੋਲੋਂ ਗੈਸ ਦੀ ਆਈ ਡੀ ਅਤੇ ਮੇਰੇ ਆਧਾਰ ਕਾਰਡ ਨੰਬਰ ਦੀ ਆਈ ਡੀ ਲਈ ਜੋ ਕਿ ਗੈਸ ਦੀ ਆਈ ਡੀ ਸੀਗੀ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਅਤੇ ਮੇਰੇ ਆਧਾਰ ਕਾਰਡ ਦੇ ਪਿਛਲੇ ਚਾਰ ਅੰਕ ਜਿਵੇਂ ਤਿੰਨ ਦੋ ਪੰਜ ਅੱਠ ਸੀਗੇ ਅਤੇ ਉਹਨਾਂ ਨੇ ਦੋਨੇ ਜਮਾਂ ਕਰ ਲਏ ਅਤੇ ਜਮਾਂ ਕਰਕੇ ਅਤੇ ਮੈਨੂੰ ਦੱਸਿਆ ਕਿ ਹੁਣ ਤੁਹਾਨੂੰ ਇਹਨਾਂ ਦੀ ਜਗ੍ਹਾ ਜਿਹੜਾ ਵੀ ਤੂੰ ਵੀ ਤੁਹਾਡਾ ਨਵਾਂ ਅਪਾਰਮੈਂਟ ਆ ਉੱਥੇ ਹੁਣ ਤੁਹਾਨੂੰ ਸਿਲੰਡਰ ਉਸੇ ਐਡਰੈਸ 'ਤੇ ਮਿਲ ਜਾਇਆ ਕਰੇਗਾ ਮੈਂ ਨਵਾਂ ਡਰੈਸ ਲਿਖਵਾਇਆ ਇਸ ਲਈ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ